ਕੁਝ ਮਹੀਨੇ ਪਹਿਲਾਂ ਅਸੀਂ ਪੰਦਰ੍ਹਾਂ ਨਵੇਂ ਖੇਤ ਲਏ ਸਨ ਜਿਹਨਾਂ ਵਿੱਚ ਅਸੀਂ ਇੱਕ ਨਵਾਂ ਮੋਟਰ ਬੋਰ ਕਰਵਾਇਆ ਹੈ ਉਸ ਮੋਟਰ ਬੋਰ ਨੂੰ ਚਲਾਉਣ ਲਈ ਬਿਜਲੀ ਦੀ ਲੋੜ ਪੈਂਦੀ ਹੈ ਕਿਉਂਕਿ ਜਨਰੇਟਰ 'ਤੇ ਜੇ ਅਸੀਂ ਚਲਾਉਂਦੇ ਹਾਂ ਤਾਂ ਸਾਡਾ ਡੀਜ਼ਲ ਪੈਟਰੋਲ ਦਾ ਖ਼ਰਚਾ ਬਹੁਤ ਜ਼ਿਆਦਾ ਆਉਂਦਾ ਏ ਜਿਸ ਨਾਲ਼ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਜ਼ਿਆਦਾ ਪੈਸੇ ਲੱਗਦੇ ਹਨ ਇਸ ਲਈ ਅਸੀਂ ਮੋਟਰ ਕਨੈਕਸ਼ਨ ਨਵਾਂ ਲੈਣਾ ਚਾਹੁੰਦੇ ਹਨ ਜਿਸ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਚਾਰ ਫੇਸ ਦਾ ਮੋਟਰ ਪਾਵਰ ਕਨੈਕਸ਼ਨ ਚਾਹੀਦਾ ਹੈ ਜਿਸ ਦੇ ਨਾਲ਼ ਕਿ ਸਾਡੀ ਮੋਟਰ ਕਨੈਕਸ਼ਨ ਵਧੀਆ ਚੱਲ ਸਕਦੀ ਅਤੇ ਖੇਤੀਬਾੜੀ ਵਧੀਆ ਹੋ ਸਕਦੀ ਹੈ